ਮੈਂ ਬੀਐਡ ਪਹਿਲੇ ਸਾਲ ਦੀ ਵਿਦਿਆਰਥਣ ਹਾਂ ਮੇਰਾ ਮਨਪਸੰਦੀ ਦਾ ਲੇਖ ਅਸੀਂ ਇੱਕ ਚੰਗੇ ਅਧਿਆਪਕ ਕਿੱਦਾਂ ਬਣ ਸਕਦੇ ਹਾਂ ਹੈ ਇਹ ਲੇਖ ਪ੍ਰੋਫੈਸਰ ਵੀਰਇੰਦਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ ਉਹ ਸਾ ਉਹ ਇੱਕ ਆਲਮ ਲੇਖਕ ਹੋਣ ਦੇ ਨਾਲ ਨਾਲ ਸਾਡੇ ਅਧਿਆਪਕ ਵੀ ਹਨ ਵਰਿੰਦਰ ਸਰ ਸਾਨੂੰ ਬੀਐਡ ਦੇ ਪਹਿਲੇ ਸਾਲ ਵਿੱਚ ਫਿਲੋਸਫੀ ਅਤੇ ਸਮਾਜਿਕ ਸਿੱਖਿਆ ਦਾ ਵਿਸ਼ਾ ਪੜ੍ਹਾਉਂਦੇ ਹਨ ਸਰ ਸਰ ਸਾਨੂੰ ਫਿਲੋਸਫੀ ਇੰਨਾ ਚੰਗੇ ਤਰੀਕੇ ਨਾਲ ਪੜ੍ਹਾਉਂਦੇ ਹਨ ਕਿ ਉਸਦਾ ਪ੍ਰਭਾਵ ਸਾਡੇ ਨਿੱਜੀ ਜੀਵਨ 'ਤੇ ਸਾਡੀ ਸੋਚ 'ਤੇ ਸਾਡੇ ਗੁਣਾਂ 'ਤੇ ਵੀ ਪੈ ਰਿਹਾ ਹੈ ਇਸ ਤਰ੍ਹਾਂ ਹੀ ਸਰ ਦੇ ਲੇਖ ਵੀ ਇੱਦਾਂ ਹੀ ਕਮਾਲ ਕਰਦੇ ਹਨ ਜਿਵੇਂ ਕਿ ਮੈਂ ਫਿਲੋਸਫੀ ਪਹਿਲੀ ਵਾਰ ਪੜ੍ਹ ਰਹੀ ਹਾਂ ਪਰ ਸਰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ ਕਿ ਮੇਰਾ ਇਹ ਹੁਣ ਫੇਵਰਟ ਸਬਜੈਕਟ ਹੈ ਸਰ ਦੀ ਕਲਾਸ ਲਗਾਉਣੀ ਮੈਨੂੰ ਇੰਨੀ ਚੰਗੀ ਲੱਗਦੀ ਹੈ ਕਿਉਂਕਿ ਸਰ ਸਾਨੂੰ ਇੰਨੀਆਂ ਵਧੀਆ ਵਧੀਆ ਗੱਲਾਂ ਦੱਸਦੇ ਹਨ ਜਿਸ ਦਾ ਇੰਪੈਕਟ ਸਰ ਦਾ ਹਮੇਸ਼ਾ ਪੈਂਦਾ ਚਾਹੇ ਅੱਜ ਨਾ ਪਵੇ ਚਾਹੇ ਕੱਲ੍ਹ ਨਾ ਪਵੇ ਪਰ ਹਮੇਸ਼ਾ ਪੈਂਦਾ ਹੈ ਕੱਲ੍ਹ ਪਵੇ ਪਰਸੋਂ ਪਵੇ ਹਮੇਸ਼ਾ ਪੈਦਾ ਹੈ ਸਰ ਦੇ ਸਰ ਦੇ ਵਿੱਚ ਇੱਕ ਇੰਨਾ ਚੰਗਾ ਲੇਖਕ ਛੁਪਿਆ ਹੋਇਆ ਹੈ ਕਿ ਜਿਸ ਦਾ ਪ੍ਰਭਾਵ ਉਸ 'ਤੇ ਉਸਦੇ ਰੀਡਰਸ 'ਤੇ ਵੀ ਪੈਂਦਾ ਹੈ ਸਰ ਦਾ ਇਹ ਲੇਖ ਪੜ੍ਹ ਕੇ ਮੈਨੂੰ ਮੇਰੇ ਵਿੱਚ ਇਹ ਚੀਜ਼ ਆਈ ਕਿ ਵੀ ਮੈਂ ਵੀ ਇੱਕ ਚੰਗੀ ਵਿਦਿਆਰਥੀ ਹੋਣ ਦੇ ਨਾਲ ਨਾਲ ਇੱਕ ਚੰਗੇ ਅਧਿਆਪਕ ਵੀ ਬਣਨਾ ਹੈ ਸਭ ਤੋਂ ਪਹਿਲਾਂ ਚੰਗੇ ਵਿਦਿਆਰਥੀ ਬਣੋਗੇ ਤਾਂ ਹੀ ਤਾਂ ਮੈਂ ਇੱਕ ਚੰਗੇ ਅਧਿਆਪਕ ਬਣ ਪਾਊਂਗੀ ਸਰ ਦੀ ਇਹ ਹੀ ਸੋਚ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਨਾਲ ਸਰ ਹੋਰ ਵੀ ਸਾਨੂੰ ਵਾਧੂ ਗੱਲਾਂ ਦੱਸਦੇ ਹਨ ਜਿਸ ਦਾ ਪ੍ਰਭਾਵ ਸਾਡੇ 'ਤੇ ਪੈਂਦਾ ਹੈ ਸਰ ਦਾ ਲੇਖ ਇੰਨਾ ਚੰਗਾ ਸੀ ਕਿ ਉਸਨੇ ਮੇਰੀ ਸੋਚ ਮੇਰੀ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਮੇਰੀ ਜਿਹੜੀ ਸੋਚ ਸੀ ਉਹ ਹੋਰ ਵੀ ਡੁੰਘਿਆਈ ਵਿੱਚ ਕਰਕੇ ਰੱਖ ਦਿੱਤੀ ਹੁਣ ਮੈਂ ਇਹ ਹਮੇਸ਼ਾ ਆਪਣਾ ਜਜ਼ਬਾ ਬਣਾਇਆ ਹੋਇਆ ਹੈ ਕਿ ਮੈਂ ਇੱਕ ਚੰਗੀ ਅਧਿਆਪਕ ਬਣੂਗੀ ਅਤੇ ਇੱਕ ਚੰਗੀ ਵਿਦਿਆਰਥੀ ਵੀ ਬਣੀ ਰਹੂੰਗੀ ਕਿਉਂਕਿ ਸਾਨੂੰ ਫਿਲੋਸਫੀ ਵਿੱਚ ਆਹ ਹੀ ਹੈ ਕਿ ਆਪਾਂ ਜਿਹੜੀ ਪੜ੍ਹਾਈ ਹੈ ਉਹ ਸਾਰੀ ਉਮਰ ਹੀ ਕਰਦੇ ਰਹਿੰਦੇ ਹਾਂ ਅਤੇ ਜੇ ਜੇ ਕੋਈ ਇੱਕ ਚੰਗਾ ਵਿਦਿਆਰਥੀ ਹੋਵੇਗਾ ਤਾਂ ਹੀ ਉਹ ਇੱਕ ਚੰਗਾ ਅਧਿਆਪਕ ਬਣ ਸਕਦਾ ਹੈ ਇਹ ਹੀ ਇਹ ਹੀ ਚੀਜ਼ ਮੈਂ ਉਸ ਲੇਖ ਤੋਂ ਸਿੱਖੀ ਅਤੇ ਇਹ ਹੀ ਚੀਜ਼ ਜੋ ਮੈਂ ਵਰਿੰਦਰ ਸਰ ਤੋਂ ਵੀ ਸਿੱਖ ਰਹੀ ਹਾਂ ਇਹ ਹੀ ਚੀਜ਼ ਮੈਨੂੰ ਉਹਨਾਂ ਦੀ ਬਹੁਤ ਪਸੰਦ ਹੈ